ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਕਿਸ ਜਗ੍ਹਾ ਵਾਸਤੇ ਚਾਹੀਦੀ ਹੈ ਰੈਂਟ ਦੇ ਚਾਹੀਦੀ ਹ ਜਾਂ ਫਿਰ ਤੁਸੀਂ ਆਪਣੀ ਖਰੀਦਣਾ ਚਾਹੁੰਦੇ ਹੋ ਰੈਂਟ ਤੇ ਚਾਹੀਦੀ ਹ ਕਿੰਨੀ ਜਗ੍ਹਾ ਚਾਹੀਦੀ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਜਿੱਦਾਂ ਕਿ ਦੋ ਮਰਲੇ ਦੀ ਜਗ੍ਹਾ ਵੀ ਹੁੰਦੀ ਹੈ ਤਿੰਨ ਮਰਲੇ ਦੀ ਵੀ ਜਗ੍ਹਾ ਹੈਗੀ ਹੈ ਡਬਲ ਸਟੋਰੀ ਬਣੀ ਹੁੰਦੀ ਹ ਇੱਕ ਬੈਡਰੂਮ ਇੱਕ ਨਾਲ ਬਾਥਰੂਮ ਇੱਕ ਰਸੋਈ ਤੁਸੀਂ ਕਿਸ ਤਰ੍ਹਾਂ ਦੀ ਲੈਣਾ ਚਾਹੁੰਦੇ ਹੋ ਅੱਛਾ ਮਤਲਬ ਕੀ ਦੋ ਤਿੰਨ ਰੂਮ ਬੈਡ ਰੂਮਸ ਹੋਣ ਤੇ ਇੱਕ ਬਾਥਰੂਮ ਜਾ ਦੋ ਬਾਥਰੂਮ ਹੋਣ ਤਾਂ ਚੱਲੇਗਾ ਠੀਕ ਹੈ ਇੰਨੇ ਕ ਦੇ ਤਾਂ ਤੁਹਾਨੂੰ ਪੰਜ ਛੇ ਹਜਾਰ ਦਾ ਰੈਂਟ ਮਿਲ ਜਾਏਗਾ ਪੰਜ ਛੇ ਹਜਾਰ ਤੱਕ ਵੀ ਤੁਹਾਨੂੰ ਮਿਲ ਸਕਦੀ ਹੈ ਜੇ ਤੁਸੀਂ ਕੱਲਾ ਰੂਮ ਯੂਜ ਕਰਨਾ ਹੋਵੇ ਤਾਂ ਤੁਹਾਨੂੰ ਮਿਲ ਜਾਏਗਾ ਜੇ ਤੁਸੀਂ ਪੂਰਾ ਘਰ ਯੂਜ ਕਰਨਾ ਚਾਹੁੰਦੇ ਹੋ ਤੇ ਕੋਈ ਪੂਰੇ ਘਰ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਤੁਹਾਨੂੰ ਜਿਆਦਾ ਰੈਂਟ ਪੇ ਕਰਨਾ ਪਏਗਾ ਉਹਦੇ ਲਈ ਜਿਹੜਾ ਜਿਧਰਲੇ ਪਾਸੇ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਜਿੱਦਾਂ ਕਿ ਤੁਹਾਨੂੰ ਖੁੱਲਾ ਏਰੀਆ ਚਾਹੀਦਾ ਜਾਂ ਫਿਰ ਤੁਹਾਨੂੰ ਕੋਈ ਇਦਾਂ ਦਾ ਏਰੀਆ ਚਾਹੀਦਾ ਜਿੱਥੇ ਬਾਜ਼ਾਰ ਵਗੈੈਰਾ ਵੀ ਹੋਵੇ ਤਾਂ ਤੁਸੀਂ ਦੱਸ ਦੋ ਉਧਰਲੇ ਪਾਸੇ ਤੁਹਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਏਗੀ ਤੇ ਤੁਸੀਂ ਆ ਕੇ ਇੱਕ ਵਾਰੀ ਕੋਟੈਕਟ ਕਰ ਲਿਓ ਜਿਸ ਤਰ੍ਹਾਂ ਦਾ ਵੀ ਤੁਸੀਂ ਜੇ ਕੋਈ ਚੀਜ਼ ਪਸੰਦ ਕਰਨਾ ਚਾਹੁੰਦੇ ਹੋ ਜਗ੍ਹਾ ਦੇਖਣੀ ਹੋਵੇ ਜਾਂ ਫਿਰ ਤੁਸੀਂ ਕਿਸੇ ਹੋਰ ਜਗ੍ਹਾ ਤੇ ਜਾਣਾ ਹੋਵੇ ਤੁਸੀਂ ਇੱਕ ਵਾਰੀ ਆ ਕੇ ਚੈੱਕ ਕਰ ਸਕਦੇ ਹੋ ਹਾਂਜੀ ਹਾਂਜੀ ਤੁਸੀਂ ਮਤਲਬ ਬਾਜ਼ਾਰ ਵਾਲੇ ਪਾਸੇ ਜਾਂਦੇ ਹੋ ਕਿ ਜਗ੍ਹਾ ਲਈ ਹੈ ਅਸੀਂ ਤਾਂ ਠੀਕ ਹੈ ਤੁਸੀਂ ਆ ਕੇ ਇੱਕ ਵਾਰੀ ਰੈਣਕ ਬਾਜ਼ਾਰ ਵਾਲੇ ਪਾਸੇ ਆ ਗਏ ਚੈੱਕ ਕਰ ਲਿਓ ਉਧਰਲੇ ਪਾਸੇ ਬੋ ਜਗਾ ਹੈਗੀ ਆ ਨੇ ਤੁਸੀਂ ਆ ਕੇ ਦੇਖ ਲਿਓ ਤੁਹਾਨੂੰ ਕਿੱਦਾਂ ਦੇ ਰੂਮ ਵਧੀਆ ਲੱਗ ਰਹੇ ਨੇ ਕਿਦਾਂ ਦੀ ਜਗ੍ਹਾ ਤੁਹਾਨੂੰ ਵਧੀਆ ਲੱਗਦੀ ਸੀ ਘਰ ਵਗੈਰਾ ਬਣਿਆ ਦਾ ਮੈਂ ਸਟੋਰੀ ਚਾਹੀਦਾ ਜਾਂ ਫਿਰ ਸਿੰਗਰ ਸਟੋਰੀ ਚਾਹੀਦਾ ਗਰਾਊਂਡ ਫੋਰ ਵਾਲੇ ਹੁੰਦੇ ਨੇ ਕੁ ਉੱਪਰ ਦੋ ਤਿੰਨ ਸੋ ਵੀ ਬਣੇ ਹੁੰਦੇ ਨੇ ਤੁਸੀਂ ਆ ਕੇ ਦੇਖ ਸਕਦੇ ਹੋ ਫਾਈਨਲੀ ਤਾਂ ਇਧਰ ਹੈ ਕਿ ਉਹ ਏਰੀਆ ਦੇ ਹਿਸਾਬ ਨਾਲ ਦੱਸਿਆ ਜਾਂਦਾ ਕੁਛ ਏਰੀਆ ਡਿਵਲਪ ਟੂ ਮੈਨੇ ਕੁਛ ਅੰਡਰਵਲਪਮੈਂਟ ਵਿੱਚ ਆਉਂਦੇ ਨੇ ਤੇ ਉਹਨਾਂ ਇਹ ਉਹਨਾਂ ਦੀ ਸੀਵਰੇਜ ਸਪਲਾਈ ਬਾਰਡਰ ਸਪਲਾਈ ਵਗੈਰਾ ਦਾ ਬਿੱਲ ਵਗੈਰਾ ਸਾਰਾ ਕੁਝ ਵਿੱਚ ਹੀ ਐਡਜਸਟ ਕਰਕੇ ਤੁਹਾਨੂੰ

ਨੂੰ ਵੀਰੋ